ਮੈਂ ਜਿਹੜਾ ਆਪਣਾ ਐਕਸਪੀਰੀਅੰਸ ਆ ਔਨਲਾਈਨ ਫਲਿੱਪਕਾਟ ਤੋਂ ਮੈਂ ਕੁਝ ਕੰਨਟੇਨਰ ਮੰਗਵਾਏ ਸੀ ਸਟੋਰੇਜ ਕੰਨਟੇਨਰ ਅਤੇ ਉਹਦੇ ਵਿੱਚ ਮੈਨੂੰ ਸਭ ਤੋਂ ਜ਼ਿਆਦਾ ਵਧੀਆ ਗੱਲ ਇਹ ਲੱਗੀ ਇੱਕ ਤਾਂ ਉਹ ਮੈਨੂੰ ਬੜਾ ਜਲਦੀ ਡਿਲੀਵਰ ਹੋ ਗਿਆ ਔਡਰ ਅਤੇ ਦੂਜੇ ਪਾਸੇ ਇਹ ਹੋਇਆ ਕਿ ਉਸ ਉਹਦੇ ਵਿੱਚ ਜਿਹੜਾ ਸਾਈਜ਼ ਅਤੇ ਸ਼ੇਪ ਸੀ ਉਹ ਬੜੀ ਫਾ ਵਧੀਆ ਸੀ ਉਹਨਾਂ ਦੀ ਦੇਖਣ ਦੇ ਲਈ ਅਤੇ ਉਹਨਾਂ ਦਾ ਜਿਹੜਾ ਰੇ ਬ ਰੇਟ ਸੀ ਉਹ ਬਜ਼ਾਰੀ ਰੇਟ ਦੇ ਨਾਲੋਂ ਘੱਟ ਸੀ